ਹੈਲੋ ਨਮਸਕਾਰ ਜੀ ਮੈਂ ਸਿਲਾਈ ਅਤੇ ਬੁਣਾਈ ਬਾਰੇ ਦੱਸਣਾ ਤੀ ਤਕਨੀਕੀ ਦੱਸਣ ਲੱਗੀ ਵੀ ਕੀ ਹੁੰਦੀ ਹੈ ਦੇਖੋ ਸਿਲਾਈ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਅਤੇ ਬੁਣਾਈ ਦਾ ਵੀ ਮੈਂ ਬੁਣਾਈ ਵਿੱਚ ਰਾਹ ਜਾਂਦਿਆ ਦੇ ਜਿਹੜੇ ਮਰਜੀ ਲੱਭਣ 'ਤੇ ਉਹਨਾਂ ਨੂੰ ਉਡਾ ਕੇ ਅਤੇ ਬੁਣ ਲੈਂਦੀ ਰਹੀ ਹਾਂ ਅਤੇ ਸਿਲਾਈ ਦੀ ਵੀ ਮੈਨੂੰ ਕੋਈ ਨਹੀਂ ਹੈਗੀ ਕਿਉਂਕਿ ਮੇਰੇ ਪੇਰੈਂਟਸ ਜਿਹੜੀ ਨਾ ਮੇਰੇ ਨਾ ਮੰਮੀ ਟੇਲਰ ਸੀਗੇ ਉਹਨਾਂ ਕੋਲੋਂ ਅਸੀਂ ਸਿਲਾਈ ਸਾਰੀ ਸਿੱਖੀ ਤੀ ਇਹ ਮੈਨੂੰ ਸਿਲਾਈ ਸਾਰੀ ਆਉਂਦੀ ਤਕਰੀਬਨ ਐਸੀ ਗੱਲ ਨਹੀਂ ਹੈਗੀ ਮੈਂ ਬਹੁਤ ਵਧੀਆ ਸਿਲਾਈ ਕਰ ਸਕਦੀ ਹਾਂ ਅਤੇ ਬੁਣਾਈ ਵੀ ਬੁਣਾਈ ਦੀ ਵੀ ਮੈਨੂੰ ਕੋਈ ਵੀ ਸੋਕਸ ਵਗੈਰਾ ਬੱਚਿਆਂ ਦੀ ਕੋਈ ਵੀ ਟੀ ਸ਼ਰਟਾਂ ਬਣਾਉਣੀਆਂ ਮੈਂ ਇਹਨਾਂ ਦੇ ਛੋਟੀਆਂ ਛੋਟੀਆਂ ਨਿੱਕਰਾਂ ਵਗੈਰਾ ਕੋਈ ਚੀਜ਼ ਐਸੀ ਨਹੀਂ ਜਿਹੜੀ ਨਹੀਂ ਉਹਨਾਂ ਮੈਂ ਬੁਣੀ ਹੱਥ ਦੇ ਗਲੱਬਜ਼ ਵਗੈਰਾ ਬਣਾ ਸਕਦੀ ਹੋ ਹਰੇਕ ਚੀਜ਼ ਹੀ ਬਣਾ ਲੈਂਦੀ ਹਾਂ ਰਹੀ ਆਪਣੇ ਬੱਚਿਆਂ ਦੇ ਵਾਸਤੇ ਮੈਂ ਖੁਦ ਹੀ ਟਾਰਰੀਆਂ ਟੋਪੀਆਂ ਵਗੈਰਾ ਕੋਟੀਆਂ ਜਾਂ ਜੋ ਪਜਾਮੀਆਂ ਪਜੁਮੀਆਂ ਵਗੈਰਾ ਸਭ ਬੁਣ ਲੈ ਬੁਣਾਈ ਵੀ ਕਰ ਸਕਦੀ ਸੀ ਤੋ ਉਸ ਤੋਂ ਬਾਅਦ ਸਿਲਾਈ ਦੀ ਰਹੀ ਗੱਲ ਸਿਲਾਈ ਦੀ ਆਪਣੇ ਬੱਚੇ ਦੀਆਂ ਪੈਂਟਾਂ ਸ਼ਰਟਾਂ ਆਪ ਘਰ ਬਣਾ ਲੈਂਦੀ ਰਹੀ ਹਾਂ ਅਤੇ ਆਪਣੀ ਬਹੂ ਰਾਣੀ ਦੀਆ ਜੋ ਨੂੰਹ ਹੈ ਹੁਣ ਪਹਿਲੇ ਤਾਂ ਐਹ ਉਹਨਾਂ ਦੇ ਵੀ ਮੈਂ ਸਾਰੇ ਕੱਪੜੇ ਆਪਣੇ ਮੈਂ ਜਿੰਨੇ ਵੀ ਕੱਪੜੇ ਹੈ ਆਪਣੀਆਂ ਨੂਹਾਂ ਜੋ ਵਿਆਹੀਆਂ ਉਹਨਾਂ ਦੇ ਦੋ ਦਾਜ ਵਰੀ ਦਾ ਜੋ ਕੱਪੜਾ ਉਹ ਮੈਂ ਖੁਦ ਘਰ ਆਪ ਹੀ ਤਿਆਰ ਕਰਦੀ ਹਾਂ ਮੈਂ ਕਿਸੇ ਕੋਲ ਨਹੀਂ ਉਹ ਤਿਆਰ ਕਰਾਉਂਦੀ ਹੈਗੀ ਉਹਨਾਂ ਦੇ ਵੀ ਸਾਰੇ ਕੱਪੜੇ ਮੈਂ ਘਰ ਸਿਓਂਦੀ ਹਾਂ ਕੋਈ ਵੀ ਅੱਜ ਕੱਲ ਜੋ ਵੀ ਪੈਂਟ ਪਲਾਜੋ ਜੇ ਅਫਗਾਨੀ ਸਲਵਾਰਾਂ ਸੁਲਵੁਰਾਂ ਜੋ ਵੀ ਅੱਜ ਕੱਲ੍ਹ ਦਾ ਚੱਲਿਆ ਟਰੈਂਡ ਹੈ ਉਹ ਟਰੈਂਡ ਦੇ ਹਿਸਾਬ ਨਾਲ ਮੈਂ ਸਾਰਾ ਕੰਮ ਕਰ ਖੁਦ ਕਰ ਸਕਦੀ ਹਾਂ ਹਾਂ ਮੈਨੂੰ ਇੰਨਾ ਕੁ ਸ਼ੋਂਕ ਸੀਗਾ ਬਾਕੀ ਮੈਂ ਆਪਣੇ ਭਵਿੱਖ ਦੇ ਵਿੱਚ ਇਹ ਵੀ ਸੋਚਿਆ ਕਿ ਸਿੱਖਣਾ ਜਿਹੜਾ ਉਹ ਸਭ ਤੋਂ ਵਧੀਆ ਹੈ ਖੋਜ ਕੱਢਣੀ ਚਾਹੀਦੀ ਆ ਚੀਜ਼ ਦੀ ਜਿਹੜੀ ਨਵੀਂ ਤੋਂ ਨਵੀਂ ਖੋਜ ਹੋਏ ਸਿੱਖਣਾ ਜਿਹੜਾ ਨਾ ਉਹ ਸਭ ਤੋਂ ਵਧੀਆ ਹੈ ਵੀ ਕੋਈ ਨਾ ਕੋਈ ਆਪਣੇ ਤੋਂ ਕੋਈ ਨਵਾਂ ਨਾ ਨਵਾਂ ਮੈਨੂੰ ਸਲਊਸ਼ਨ ਲੱਭਣਾ ਚਾਹੀਦਾ ਹੈ ਨਵਾਂ ਦਾ ਨਵਾਂ ਪੁਆਇੰਟ ਲੱਭਣਾ ਚਾਹੀਦਾ ਹੈ ਮੈਂ ਖੁਦ ਹੀ ਉਹ ਸਮਾਨ ਨੂੰ ਉਹ ਮਤਲਬ ਸਿੱਖਣਾ ਚਾਹੁੰਦੀ ਹਾਂ ਮੈਨੂੰ ਕੋਈ ਨਾ ਕੋਈ ਨਵਾਂ ਪਲਾ ਕੋਈ ਕਿਸੇ ਕਿਸਮ ਦਾ ਮੈਨੂੰ ਕਿਤੋਂ ਭਲਾ ਨਵੀਂ ਚੀਜ਼ ਮਿਲੇ ਕਿ ਮੈਂ ਉਹ ਸੀ ਕੇ ਉਹਨੂੰ ਤਿਆਰ ਕਰਦੀ ਹਾਂ ਨਾਲ ਮੈਂ ਉਹ ਕਰ ਲੈਂਦੀ ਹਾਂ ਖੁਦ ਕਰ ਲੈਂਦੀ ਹਾਂ ਮੈਂ ਉਹ ਦੀ ਚੀਜ਼ ਦੇਖਦੀ ਦੇਖਦੀ ਹਾਂ ਕਿ ਇਹ ਮੈਂ ਕਰਨੀ ਕਰਨੀ ਆ ਜੋ ਮਰਜ਼ੀ ਹੋਵੇ ਮੈਨੂੰ ਇੰਨਾ ਕੁ ਸ਼ੌਂਕ ਹੈਗਾ ਅਤੇ ਹੁਣ ਅੱਜ ਕੱਲ੍ਹ ਨੈਟ 'ਤੇ ਸਭ ਕੁਝ ਆਉਂਦਾ ਉੱਥੋਂ ਵੇਖ ਲਈਦਾ ਜੋ ਵੀ ਜਿਸ ਤਰ੍ਹਾਂ ਦਾ ਵੀ ਕੋਈ ਸੀਨ ਆਇਆ ਬੁਣਨਾ ਆ ਬਣਾਈਆਂ ਆਉਂਦੀਆਂ ਸਭ ਕੁਝ ਨੈਟ ਤੋਂ ਵੇਖ ਕੇ ਉੱਦਦਾਂ ਹੀ ਅਸੀਂ ਕਰਕੇ ਮੈਂ ਤਿਆਰ ਕਰਕੇ ਰੱਖ ਸਕਦੀ ਹਾਂ ਇਹੋ ਹੀ ਮੇਰਾ ਸਿਲਾਈ ਦਾ ਅਤੇ ਬੁਣਾਈ ਦਾ ਹੁਨਰ ਹੈ ਇਹ ਹੀ ਮੇਰੀ ਤਕਨੀਕ ਹੈਗੀ ਠੀਕ